ਪੰਜਾਬ ਵਿੱਚ ਸਮੇਂ ਦੇ ਨਾਲ਼ ਨਾਲ਼ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਰਹੀਆਂ ਹਨ ਮੌਜੂਦਾ ਸਮੇਂ ਵਿੱਚ ਸਿੱਖਿਆ ਦੇ ਤਕਨੀਕੀ ਖੇਤਰ ਵਿੱਚ ਆਮ ਤੌਰ 'ਤੇ ਜ਼ਿਆਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਤਕਨੀਕੀ ਖੇਤਰ ਵਿੱਚ ਵੱਧ ਨੌਕਰੀਆਂ ਹੋਣ ਕਾਰਨ ਇਸ ਸਿੱਖਿਆ ਪ੍ਰਣਾਲੀ ਤਕਨੀਕੀ ਸਿੱਖਿਆ ਪ੍ਰਣਾਲੀ ਨੂੰ ਜ਼ਿਆਦਾ ਉਤਸਾਹਿਤ ਕੀਤਾ ਜਾ ਰਿਹਾ ਹੈ ਹਰ ਖੇਤਰ ਵਿੱਚ ਵੱਧ ਨੌਕਰੀਆਂ ਹੋਣ ਕਾਰਨ ਸਿੱਖਿਆ ਖੇਤਰ ਦੇ ਟੈਕਨੀਕਲ ਖੇਤਰ ਵਿੱਚ ਬੱਚਿਆਂ ਦਾ ਰੁਝਾਨ ਵੱਧ ਰਿਹਾ ਹੈ ਆਮ ਤੌਰ ਦੇ ਉੱਤੇ ਜਿਹੜਾ ਜਿਹੜਾ ਖੇਤਰ ਹੈਗਾ ਹਊਮੈਨਟੀਜ਼ ਅਤੇ ਸੋਸ਼ਲ ਸਾਇਸਿਸ ਵਾਲਾ ਉਹਦੇ ਵਿੱਚ ਨੌਕਰੀਆਂ ਘੱਟ ਮ ਮਿਲਦੀਆਂ ਹਨ ਇਸ ਕਾਰਨ ਉਸ ਖੇਤਰ ਵਿੱਚ ਜ਼ਿਆਦਾ ਬੱਚੇ ਦਾਖ਼ਲ ਨਹੀਂ ਲੈ ਰਹੇ ਪਰ ਇਸ ਖੇਤਰ ਦੇ ਵੀ ਹਾਏਅਰ ਜਾਂ ਉੱਚ ਸਿੱਖਿਆ ਦੇ ਖੇਤਰ ਵਿੱਚ ਜਾ ਜਾਣ ਦੇ ਨਾਲ਼ ਵੱਧ ਨੌਕਰੀ ਪ੍ਰਦਾਨ ਹੋ ਸਕਦੇ ਹਨ ਇਸ ਤੋਂ ਇਲਾਵਾ ਸਾਇੰਸ ਬੇਸਿਕ ਸਾਇੰਸ ਅਤੇ ਪੇਔਰ ਸਾਇੰਸਿਸ ਤੋਂ ਇਲਾਵਾ ਐਗਰੀਕਲਚਰ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਵੀ ਕਾਫ਼ੀ ਰੁਝਾਨ ਵੇਖਣ ਨੂੰ ਮਿਲ ਰਹੇ ਹਨ